ਹੈਲੋ ਹਾਂਜੀ ਵੋਲਵੋ ਬੱਸਾਂ ਤੋਂ ਬੋਲਦੇ ਪਏ ਹਾਂਜੀ ਅਸੀਂ ਟੂਰੈਸਟ ਹਾਂ ਇਹ ਮੈਂ ਇੱਥੋਂ ਹਰਿਆਣੇ ਤੋਂ ਤਰਨ ਤਾਰਨ ਆਈ ਹੋਈ ਹਾਂ ਹਾਂਜੀ ਤਰਨ ਤਾਰਨ ਸਿਟੀ ਦੇ ਨਾਲ ਲੱਗਦੇ ਹੋਰ ਹੋਰ ਕਿਹੜੀਆਂ ਸੀਟੀਜ ਆ ਜਿਹੜੀਆਂ ਕਿ ਅਸੀਂ ਘੁੰਮਣਾ ਚਾਹੁੰਦੇ ਹਾਂ ਅਤੇ ਤੁਹਾਡੀਆਂ ਬੱਸਾਂ ਕਦੋਂ ਕਿਸ ਟਾਈਮ 'ਤੇ ਤੁਰਨੀਆਂ ਹੈ ਦੱਸ ਸਕਦੇ ਹੋ ਹਾਂਜੀ ਠੀਕ ਜੇ ਹਾਂਜੀ ਅੱਛਾ ਠੀਕ ਹੈ ਅਤੇ ਜਦੋਂ ਆਪਾਂ ਵਾਪਸ ਜਾਣਾ ਹਰਿਆਣੇ ਨੂੰ ਤਾਂ ਉਦੋਂ ਤੁਹਾਡੀ ਬੱਸ ਕਦੋਂ ਮਤਲਬ ਕਿ ਵਾਪਸ ਹੋਊਗੀ ਟਾਈਮ ਦੱਸੋਗੇ ਹਾਂਜੀ

ਠੀਕ ਠੀਕ ਓ